ਮੈਨੂੰ ਹਜੇ ਵੀ ਯਾਦ ਹੈ ਕਿ ਜਦੋਂ ਮੈਂ ਗੇਮਾਂ ਖੇਡਣੀਆਂ ਸ਼ੁਰੂ ਕੀਤੀਆਂ ਸੀ ਉਦੋਂ ਗੇਮਿੰਗ ਇੰਡਸਟਰੀ ਇੰਨੀ ਵੱਡੀ ਨਹੀਂ ਸੀ ਪਰ ਹੁਣ ਜਦੋਂ ਨਵਾਂ ਟਾਈਮ ਆਇਆ ਹੈ ਤਾਂ ਗੇਮਿੰਗ ਇੰਡਸਟਰੀ ਇੰਨ ਭਾਰਤ ਦਾ ਇੰਨਾ ਵੱਡਾ ਪਾਰਟ ਬਣ ਚੁੱਕੀ ਹੈ ਕਿ ਅੱਜ ਦੇ ਟਾਈਮ ਵਿੱਚ ਬਹੁਤ ਜ਼ਿਆਦਾ ਵੱਡੇ ਵੱਡੇ ਟੂਰਨਾਮੈਂਟ ਵੀ ਹੁੰਦੇ ਹਨ ਗੇਮਾਂ ਵਾਸਤੇ ਕਿੰਨੇ ਲੋਕ ਗੇਮਾਂ ਦੇ ਟੂਰਨਾਮੈਂਟ ਜਿੱਤਦੇ ਹਨ ਅਤੇ ਕਿੰਨਾ ਪੈਸਾ ਕਮਾਉਂਦੇ ਹਨ ਅਤੇ ਹੋਰ ਵੀ ਬੜੇ ਜ਼ਿਆਦਾ ਇਨਾਮ ਵੀ ਜਿੱਤਦੇ ਹਨ ਅੱਜ ਦੇ ਟਾਈਮ ਵਿੱਚ ਗੇਮਾਂ ਖੇਡਣਾ ਇੱਕ ਬੜਾ ਵੱਡਾ ਟਰੈਂਡ ਬਣ ਚੁੱਕਾ ਹੈ ਅਤੇ ਲੋਕ ਗੇਮਾਂ ਖੇਡ ਕੇ ਬੜੇ ਪੈਸੇ ਕਮਾਉਂਦੇ ਹਨ ਇਸ ਲਈ ਅੱਜ ਦੇ ਲੋਕ ਦੁਨੀਆ ਵਿੱਚ ਲੋਕਾਂ ਦੇ ਘਰ ਦੇ ਵੀ ਬੜਾ ਜ਼ਿਆਦਾ ਸਪੋਰਟ ਕਰਦੇ ਹਨ ਲੋਕਾਂ ਨੂੰ ਕਿ ਗੇਮਾਂ ਖੇਡੋ ਅਤੇ ਪੈਸੇ ਕਮਾਓ ਅਤੇ ਅਹ ਤਰੱਕੀ ਕਰੋ ਕਿਉਂਕਿ ਅੱਜ ਦੀ ਦੁਨੀਆ ਵਿੱਚ ਗੇਮਾਂ ਦਾ ਵੀ ਇੱਕ ਬੜਾ ਵੱਡਾ ਸਕੋਪ ਹੈ ਅੱਜ ਕੱਲ੍ਹ ਦੀ ਦੁਨੀਆ ਵਿੱਚ ਤਾਂ ਲੋਕ ਗੇਮਾਂ ਖੇਡ ਕੇ ਬੜੇ ਮਸ਼ਹੂਰ ਵੀ ਹੋ ਜਾਂਦੇ ਹਨ ਕਿ ਉਹ ਅੱਜ ਬਾਲੀਵੁੱਡ ਦੇ ਐਕਟਰਾਂ ਨੂੰ ਵੀ ਪਿੱਛੇ ਛੱਡ ਦਿੰਦੇ ਹਨ ਆਪਣੀ ਪੋਪੁਲੈਰਟੀ ਦੇ ਵਿੱਚ ਲੋਕਾਂ ਦੇ ਇਹ ਕਿੰਨੇ ਜ਼ਿਆਦਾ ਸੋਸ਼ਲ ਪਲੇਟਫੋਮਸ 'ਤੇ ਕਿੰਨੇ ਕਿੰਨੇ ਜ਼ਿਆਦਾ ਫੋਲੋਵਰਸ ਵੀ ਗੇਮਾਂ ਖੇਡਣ ਨਾਲ ਹੀ ਵੱਧ ਜਾਂਦੇ ਹਨ ਲੋਕ ਤਾਂ ਗੇਮਾਂ ਦੇ ਪਿੱਛੇ ਅੱਜ ਕੱਲ੍ਹ ਦੀਵਾਨੇ ਹੀ ਹੋ ਚੁੱਕੇ ਹਨ ਕਿਉਂਕਿ ਲੋਕਾਂ ਨੂੰ ਇੱਕ ਇੱਕ ਤਾਂ ਮਜ਼ੇ ਕਰਨ ਦਾ ਸੋਰਸ ਮਿਲ ਚੁੱਕਾ ਹੈ ਉੱਤੋਂ ਟਾਈਮ ਪਾਸ ਕਰਨ ਵਾਸਤੇ ਵੀ ਇੱਕ ਜਗ੍ਹਾ ਮਿਲ ਚੁੱਕੀ ਹਨ ਜਿੱਥੇ ਉਹ ਬੜਾ ਜ਼ਿਆਦਾ ਆਪਣਾ ਧਿਆਨ ਲਾ ਕੇ ਗੇਮਾਂ ਖੇਡਦੇ ਹਨ ਅਤੇ ਉਹਨਾਂ ਨੂੰ ਖੁਸ਼ੀ ਵੀ ਮਿਲਦੀ ਹਨ ਲੋਕ ਅੱਜ ਕੱਲ੍ਹ ਸਮਝਦੇ ਹਨ ਕਿ ਗੇਮਾਂ ਸਿਰਫ ਮਜ਼ੇ ਵਾਸਤੇ ਹੀ ਹਨ ਪਰ ਉਹ ਆਹ ਨਹੀਂ ਸੋਚਦੇ ਕਿ ਅੱਜ ਕੱਲ੍ਹ ਲੋਕ ਇਹ ਤੋਂ ਪੈਸਾ ਵੀ ਬੜਾ ਕਮਾ ਸਕਦੇ ਹੈ ਅੱਜ ਕੱਲ੍ਹ ਦੀ ਦੁਨੀਆ ਵਿੱਚ ਇਸ ਤਰ੍ਹਾਂ ਦੇ ਕਾਫੀ ਘੋ ਘੱਟ ਲੋਕ ਹੀ ਬਚੇ ਹਨ ਜਿਹੜੇ ਹਜੇ ਵੀ ਇਹਨੂੰ ਫਾਲਤੂ ਹੀ ਸਮਝਦੇ ਹਨ ਪਰ ਜਿੱਦਾਂ ਜਿੱਦਾਂ ਟਾਈਮ ਬੀਤ ਰਿਹਾ ਹੈ ਓਦਾਂ ਓਦਾਂ ਉਹ ਲੋਕ ਵੀ ਸਮਝ ਸਮਝੀ ਜਾ ਰਹੇ ਹਨ ਕਿ ਲੋਕ ਗੇਮਾਂ ਖੇਡ ਕੇ ਵੀ ਬੜੀ ਜ਼ਿਆਦਾ ਤਰੱਕੀ ਕਰ ਸਕਦੇ ਹਨ ਜਿਸ ਤਰ੍ਹਾਂ ਭਾਰਤ ਵਿੱਚ ਗੇਮਿੰਗ ਇੰਡਸਟਰੀ ਬਣ ਚੁੱਕੀ ਹੈ ਉਸੇ ਤਰ੍ਹਾਂ ਬਾਹਰ ਦੀ ਕੰਟਰੀਆਂ ਵਿੱਚ ਵੀ ਗੇਮਿੰਗ ਇੰਡਸਟਰੀਆਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਹਨ ਤਾਂ ਲੋਕ ਹੌਲੀ ਹੌਲੀ ਸਮਝੀ ਜਾ ਰਹੇ ਹਨ ਕਿ ਗੇਮਾਂ ਖੇਡਣਾ ਇੱਕ ਬੜਾ ਵੱਡਾ ਸਕੋਪ ਹੈ ਅਤੇ ਬਸ ਇਸ ਤੋਂ ਪੈਸੇ ਕਮਾਉਂਦੇ ਰਹੋ ਅਤੇ ਖੁਸ਼ ਰਹੋ ਅਤੇ ਗੇਮਾਂ ਤੋਂ ਪੈਸਾ ਕਮਾਉਣਾ ਵੀ ਇੰਨਾ ਸੌਖਾ ਤਰੀਕਾ ਹੈ ਕਿ ਲੋਕ ਘਰ ਬਹਿ ਬਹਿ ਕੇ ਹੀ ਗੇਮਾਂ ਖੇਡ ਸਕਦੇ ਹਨ ਅਤੇ ਪੈਸੇ ਕਮਾ ਸਕਦੇ ਹਨ